ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੀ ਐਪ ਤੋਂ ਪੰਦਰਾਂ ਦਿਨ ਪਹਿਲਾਂ ਚੂੜੀਆਂ ਮੰਗਵਾਈਆਂ ਸੀ ਜੋ ਚੂੜੀਆਂ ਮੇਰੇ ਕੋਲ ਪਹੁੰਚ ਚੁੱਕੀਆਂ ਹਨ ਅਤੇ ਉਹਨਾਂ ਦੀ ਪੈਕਿੰਗ ਬਹੁਤ ਖਰਾਬ ਹੈ ਉਹ ਬਿਲਕੁਲ ਵੀ ਚੰਗੀ ਤਰ੍ਹਾਂ ਪੈਕ ਨਹੀਂ ਕੀਤੀਆਂ ਹੋਈਆਂ ਹਨ ਅਤੇ ਜਦੋਂ ਮੈਂ ਉਹਨਾਂ ਨੂੰ ਖੋਲ੍ਹ ਕੇ ਦੇਖਿਆ ਉਹਨਾਂ ਦੀ ਕੁਐਲਿਟੀ ਬਹੁਤ ਹੀ ਘਟੀਆ ਹੈ ਅਤੇ ਬਹੁਤ ਹੀ ਭਾਰੀਆਂ ਹਨ ਅਤੇ ਜਿਵੇਂ ਦੀਆਂ ਮੈਂ ਜਿਸ ਕਲਰ ਦੀਆਂ ਮੈਂ ਮੰਗਵਾਈਆਂ ਸੀ ਜਿਵੇਂ ਦੀਆਂ ਮੰਗਵਾਈਆਂ ਸੀ ਉਹ ਕਲਰ ਮੇਰੇ ਕੋਲ ਨਹੀਂ ਪਹੁੰਚਿਆ ਅਤੇ ਮੈਂ ਰੈੱਡ ਅਤੇ ਗਰੀਨ ਮੰਗਵਾਈਆਂ ਸੀ ਇਹ ਯੈਲੋ ਅਤੇ ਵਾਈਟ ਕਲਰ 'ਚ ਆ ਗਈਆਂ ਹਨ ਅਤੇ ਮੇਰੇ ਘਰ 'ਚ ਵੀ ਇਹ ਚੂੜੀਆਂ ਕਿਸੇ ਨੂੰ ਪਸੰਦ ਨਹੀਂ ਆਈਆਂ ਮੇਰੇ ਫਰੈਂਡ ਫਰੈਂਡਸ ਸਰਕਲ 'ਚ ਵੀ ਇਹ ਚੂੜੀਆਂ ਕਿਸੇ ਨੂੰ ਪਸੰਦ ਨਹੀਂ ਆਈਆਂ ਅਤੇ ਮੈਂ ਇਹ ਚੂੜੀਆਂ ਆਪਣੇ ਫਰੈਂਡਸ ਤੋਂ ਵੀ ਔਡਰ ਕਰਵਾਈਆਂ ਸੀ ਉਹਨਾਂ ਨੂੰ ਦਿਖਾ ਕੇ ਕਿ ਦੇਖੋ ਇਹ ਚੂੜੀਆਂ ਕਿੰਨੀਆਂ ਵਧੀਆਂ ਹਨ ਅਤੇ ਕਈਆਂ ਨੇ ਔਡਰ ਵੀ ਕੀਤੇ ਅਤੇ ਉਹਨਾਂ ਕੋਲ ਵੀ ਘਟੀਆ ਹੀ ਆਈਆਂ ਅਤੇ ਕਈਆਂ ਦੇ ਔਡਰ ਮੈਂ ਕੈਂਸਲ ਵੀ ਕਰਵਾਏ ਅਤੇ ਮੈਨੂੰ ਇਹ ਚੂੜੀਆਂ ਬਿਲਕੁਲ ਵੀ ਪਸੰਦ ਨਹੀਂ ਆਈਆਂ ਬਿਲਕੁਲ ਹੀ ਘਟੀਆ ਚੂੜੀਆਂ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਣ ਜਾਂ ਫਿਰ ਮੈਨੂੰ ਜੋ ਚੂੜੀਆਂ ਮੈਂ ਦੇਖੀਆਂ ਸਨ ਔਡਰ ਕੀਤੀਆਂ ਸਨ ਉਹ ਚੂੜੀਆਂ ਹੀ ਮੈਨੂੰ ਦਿੱਤੀਆਂ ਜਾਣ ਜਾਂ ਮੇਰੇ ਪੈਪ ਪੈਸੇ ਵਾਪਸ ਕੀਤੇ ਜਾਵੇ ਜੀ ਧੰਨਵਾਦ